ਅੱਜ ਦਾ ਯੁੱਗ ਵਿਗਿਆਨਿਕ ਯੁੱਗ ਹੈ ਇਸ ਯੁੱਗ ਵਿੱਚ ਟੈਕਨੋਲਜੀ ਦੇ ਕਾਰੋਬਾਰਾਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਾਰੋਬਾਰ ਇੱਦਾਂ ਦੇ ਹਨ ਜਿਨ੍ਹਾਂ ਲੋਕਾਂ ਨੂੰ ਮਤਲਬ ਕਿ ਬਹੁਤ ਜ਼ਿਆਦਾ ਫੈਸੀਲਿਟੀਜ਼ ਦਿੱਤੀਆਂ ਨੇ ਠੀਕ ਹੈ ਅਤੇ ਜਿਨਾਂ ਦਾ ਮਤਲਬ ਕਿ ਲੈਣ ਦੇਣ ਸਭ ਟੈਕਨੋਲਜੀ ਦੇ ਸਿਰ 'ਤੇ ਹੁੰਦਾ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕੋਲ ਵੀ ਟੈਕਨੋਲਜੀ ਦੇ ਬੇਸ 'ਤੇ ਹੀ ਕਾਰੋਬਾਰ ਹੈ ਕਿ ਸਾਡਾ ਕਾਰੋਬਾਰ ਵੀ ਟੈਕਨੋਲਜੀ ਦੇ ਬੇਸ 'ਤੇ ਅੱਗੇ ਵਧਿਆ ਫੁੱਲਿਆ ਅਤੇ ਸਾਡਾ ਇੱਕ ਛੋਟਾ ਜਿਹਾ ਕਾਰੋਬਾਰ ਸਾਡਾ ਆਪਣੀ ਬੁਟੀਕ ਹੈ ਜਿਹਦੇ ਵਿੱਚ ਕਿ ਮੈਂ ਇਹ ਗੱਲ ਕਹਿ ਸਕਦੀ ਐਂ ਕਿ ਮੈਂ ਜੇਕਰ ਕਿਸੇ ਕਸਟਮਰ ਕੋਲ ਆਪਣੀ ਪੇ ਕਰਾਵਾਉਨੀ ਹਾਂ ਔਨਲਾਈਨ ਕਰਦੀ ਹਾਂ ਜਾਂ ਉਹਨਾਂ ਤੋਂ ਪੇ ਕਰਾਵਾਉਨੀ ਹਾਂ ਇਹ ਸਾਰਾ ਕੰਮ ਮੇਰਾ ਔਨਲਾਈਨ ਹੀ ਚੱਲਦਾ ਜਾਨੀ ਟੈਕਨੋਲਜੀ ਦੇ ਬੇਸ 'ਤੇ ਹੀ ਚੱਲਦਾ ਹੈ ਇਸ ਕਾਰੋਬਾਰ ਨੂੰ ਲੈ ਕੇ ਅਸੀਂ ਤਾਂ ਬਹੁਤ ਖੁਸ਼ ਹਾਂ ਕਿਉਂਕਿ ਜੇਕਰ ਕਾਰੋਬਾਰ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਹ ਸਾਡੇ ਮਤਲਬ ਕੰਮ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਟੈਕਨੋਲਜੀ ਦਾ ਖੇਤਰ ਅਤੇ ਮੈਂ ਮੈਂ ਹਮੇਸ਼ਾ ਤੋਂ ਹੀ ਮਤਲਬ ਇਹਨਾਂ ਚੀਜ਼ਾਂ ਦਾ ਬਹੁਤ ਫਾਇਦਾ ਉਠਾਉਂਦੀ ਹਾਂ ਅਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਅੱਗੇ ਵੱਧਦੀ ਹਾਂ ਅਤੇ ਮੇਰੀ ਮੈਂ ਜਿਸ ਤਰ੍ਹਾਂ ਬੋਲ ਰਹੀ ਹਾਂ ਕਿ ਮੇਰੀ ਆਪਣੀ ਬੁਟੀਕ ਹੈ ਮੈਂ ਆਪਣੀ ਬੁਟੀਕ ਦੇ ਅਤੇ ਜੋ ਵੀ ਕੋਈ ਨਵਾਂ ਕੰਮ ਹੁੰਦਾ ਉਸਨੂੰ ਟੈਕਨੋਲਜੀ ਦੇ ਜਰੀਏ ਕਹਿ ਸਕੀਏ ਆਪਾਂ ਕਿ ਮੈਂ ਪੋਸਟ ਕਰਦੀ ਹਾਂ ਮੇਰੇ ਯੂਟਿਊਬ ਚੈਨਲ ਨੇ ਇੰਸਟਾ 'ਤੇ ਮੈਂ ਪੋਸਟ ਕਰਦੀ ਹਾਂ ਬਹੁਤ ਸਾਰੇ ਲੋਕ ਮੇਰੇ ਨਾਲ ਜੁੜੇ ਹੋਏ ਨੇ ਜੋ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਨੇ ਅਤੇ ਮੈਨੂੰ ਬਹੁਤ ਪਿਆਰ ਦਿੰਦੇ ਨੇ ਅਤੇ ਮੈਂ ਮਤਲਬ ਇਹ ਦੌਰ ਹੀ ਇੱਕ ਤੈਕਨੋਲਜੀ ਦਾ ਇੱਦਾਂ ਦਾ ਏ ਕਿ ਹਰ ਗੱਲ ਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਹੈ ਨਾ ਅਤੇ ਇਹਦਾ ਤੈਕਨੋਲਜੀ ਦਾ ਕਾਰੋਬਾਰ ਅਤੇ ਵਿਕਾਸ ਦੇ ਖੇਤਰ 'ਚ ਬਹੁਤ ਜ਼ਿਆਦਾ ਪ੍ਰਭਾਵ ਹੈ ਆਪਣੀ ਜਗ੍ਹਾ 'ਤੇ ਹਰ ਇਨਸਾਨ ਇਸ ਗੱਲ ਦਾ ਫਾਇਦਾ ਉਠਾ ਰਿਹਾ